ਪੀ ਟੀ ਊਸ਼ਾ ਦਾ ਪੂਰਾ ਨਾਮ ਪਿਲਾਵੁਕੰਦੀ ਤੇਕੇਪਰਰੰਬਿਲ ਊਸ਼ਾ ਹੈ ਪੀ ਟੀ ਊਸ਼ਾ ਭਾਰਤ ਦੀ ਮਹਾਨ ਐਥਲੀਟਾਂ ਵਿੱਚੋਂ ਇੱਕ ਹੈ ਜਿਸ ਨੂੰ ਅਕਸਰ ਦੇਸ਼ ਦੀ ਟਰੈਕ ਅਤੇ ਫੀਲਡ ਦੀ ਰਾਣੀ ਕਿਹਾ ਜਾਂਦਾ ਹੈ ਪੀ ਟੀ ਊਸ਼ਾ ਦਾ ਜਨਮ ਸਤਾਈ ਜੂਨ ਉੱਨੀ ਸੌ ਚੌਂਹਠ ਵਿੱਚ ਕੇਰਲ ਵਿੱਚ ਹੋਇਆ ਸੀ ਇਸ ਦੇ ਇੱਕ ਇੱਕ ਨਾਮ ਉਪ ਨਾਮ ਪਿਓਲੀ ਐਕਸਪ੍ਰੈਸ ਵੀ ਹੈ ਪੀ ਟੀ ਊਸ਼ਾ ਨੇ ਚਾਰ ਏਸ਼ੀਆਈ ਸਵਰਨ ਪਦਕ ਅਤੇ ਸੱਤ ਰੱਜਕ ਪਦਕ ਜਿੱਤੇ ਹਨ ਅਤੇ ਕੁੱਲ ਉਸ ਨੇ ਤੇਈ ਪਦਕ ਜਿੱਤੇ ਹਨ ਪੀ ਟੀ ਊਸ਼ਾ ਨੇ ਉੱਨੀ ਸੌ ਸਤੱਤਰ ਤੋਂ ਦੋ ਹਜ਼ਾਰ ਦੇ ਵਿੱਚ ਆਪਣੇ ਕਰੀਅਰ ਨੂੰ ਇੱਕ ਸੌ ਤਿੰਨ ਅੰਤਰਰਾਸ਼ਟਰੀ ਪਦਕ ਜਿੱਤੇ ਉਹ ਐਪਰੀ ਪ੍ਰਤੀਯੋਗਤਾ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਮਹਿਲਾ ਅਤੇ ਪੰਜਵੀਂ ਭਾਰਤੀ ਬਣੀ ਪੀ ਟੀ ਊਸ਼ਾ ਦੀ ਹਿੰਮਤ ਤੋਂ ਮਿਹਨਤ ਸਾਨੂੰ ਸਿੱਖਿਆ ਮਿਲਦੀ ਹੈ ਕਿ